ਮੈਂ ਖੇਤਰੀ ਰਾਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਯੋਜਿਤ ਕਿਸੇ ਵੀ ਫੋਟੋਗ੍ਰਾਫਰੀ ਮੁਕਾਬਲੇ ਦੇ ਵਿੱਚ ਹਿੱਸਾ ਨਹੀਂ ਲਿਆ ਮੈਂ ਸਿਰਫ਼ ਸਕੂਲ ਨਾਲ ਸੰਬੰਧਿਤ ਫੋਟੋਗ੍ਰਾਫਰੀ ਮੁਕਾਬਲੇ ਵਿੱਚ ਹਿੱਸਾ ਲਿਆ ਹੈ ਇਹ ਮੇਰਾ ਪਸੰਦੀਦਾ ਵਿਸ਼ਾ ਹੈ ਮੈਂ ਕੋਸ਼ਿਸ਼ ਕਰੂੰਗੀ ਅੱਗੇ ਖੇਤਰੀ ਰਾਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਯੋਜਿਤ ਕਿਸੇ ਵੀ ਫੋਟੋਗਰਾਫੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਜਿਸ ਨਾਲ ਮੈਨੂੰ ਹੋਰ ਵੀ ਪ੍ਰੋਤਸਾਹਨ ਮਿਲੇ